ਜੇਕਰ ਅਸੀਂ ਪੰਜਾਬ ਵਿੱਚ ਆਰਟ ਗੈਲਰੀਆਂ ਜਾਂ ਅਜਾਇਬ ਘਰ ਜਿਹੜੇ ਕਿ ਪੰਜਾਬ ਰਾਜ ਦੀ ਕਲਾਤਮਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਦੇ ਹੈ ਉਹਨਾਂ ਦੇ ਬਾਰੇ ਗੱਲ ਕਰੀਏ ਤਾਂ ਸਾਡੇ ਕੋਲ ਕਾਫੀ ਸਾਰੇ ਨਾਮ ਹੈ ਜਿਹੜੇ ਉਹ ਨਿਕਲ ਕੇ ਸਾਹਮਣੇ ਆਉਂਦੇ ਹੈ ਜਿਨ੍ਹਾਂ ਦੇ ਵਿੱਚੋਂ ਅਨੰਦਪੁਰ ਸਾਹਿਬ ਦੇ ਵਿੱਚ ਸਥਿਤ ਵਿਰਾਸਤ ਏ ਖਾਲਸਾ ਦਾ ਨਾਮ ਹੈ ਜਿਹੜਾ ਉਹ ਸਭ ਤੋਂ ਸਿਖਰ 'ਤੇ ਆਉਂਦਾ ਉੱਥੇ ਜਦ ਅਸੀਂ ਐਂਟਰੀ ਕਰਦੇ ਹਾਂ ਤਾਂ ਸਾਨੂੰ ਪੰਜਾਬ ਦਾ ਜਿਹੜਾ ਅਮੀਰ ਸੱਭਿਆਚਾਰ ਆ ਉਹਦੀ ਝਾਕੀ ਮਿਲਦੀ ਹੈ ਇਸ ਤੋਂ ਇਲਾਵਾ ਜਿਹੜੀਆਂ ਸਿੱਖ ਜਾਂ ਹੋਰ ਪੰਜਾਬੀ ਵਾਰਾਂ ਹੋਈਆਂ ਨੇਗੀਆਂ ਯੁੱਧ ਹੋਏ ਨੇ ਉਹਨਾਂ ਬਾਰੇ ਜਾਣਕਾਰੀ ਹੈ ਜਿਹੜੀ ਉਹ ਮਿਲਦੀ ਹੈ ਇਸ ਤੋਂ ਇਲਾਵਾ ਜਲੰਧਰ ਦੇ ਵਿੱਚ ਜਿਹੜਾ ਸਪੋਰਟਸ ਹੈਰੀਟੇਜ ਮਿਊਜ਼ੀਅਮ ਹੈਗਾ ਉਹ ਆਉਂਦਾ ਜਿੱਥੇ ਕਿ ਜਿਹੜੀਆਂ ਖੇਡਾਂ ਦੀ ਉਤਪਤੀ ਕਿਵੇਂ ਹੋਈ ਪਹਿਲਾਂ ਕਿਸ ਤਰੀਕੇ ਦੀਆਂ ਸੀਗੀਆਂ ਜਾਂ ਖੇਡਾਂ ਦੇ ਵਿੱਚ ਵਰਤੋਂ ਵਾਲੀ ਸਮੱਗਰੀ ਹੈ ਜਿਹੜੀ ਉਹ ਕਿਸ ਤਰੀਕੇ ਦੀ ਸੀਗੀ ਇਹ ਸਾਰਾ ਕੁਛ ਹੈ ਜਿਹੜਾ ਉਹ ਸਾਨੂੰ ਪਤਾ ਲੱਗਦਾ ਜੇਕਰ ਅਸੀਂ ਗੱਲ ਕਰੀਏ ਤਾਂ ਪਟਿਆਲੇ ਦੇ ਵਿੱਚ ਸ਼ੀਸ਼ ਮਹਿਲ ਜਿਹੜਾ ਹੈਗਾ ਉਹ ਵੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਰਾਜ ਦੇ ਵਿੱਚ ਇੱਕ ਪ੍ਰਮੁੱਖ ਅਜਾਇਬ ਘਰ ਹੈ ਜੋ ਕਿ ਸਾਡੇ ਪੰਜਾਬ ਦੇ ਅਮੀਰ ਵਿਰਸੇ ਨੂੰ ਦਰਸਾਉਂਦਾ